ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਛਾ ਹਾਂਜੀ ਦੱਸੋ ਮੈਮ ਕਾਫੀ ਜ਼ਿਆਦਾ ਸਾਡੀ ਨਰਸਰੀ ਵਿੱਚ ਫੁੱਲ ਹੈ ਜਿਨ੍ਹਾਂ ਵਿੱਚ ਗੁਲਾਬ ਹੈ ਗੇਂਦੇ ਦਾ ਹੈ ਔਰ ਹਾਂਜੀ ਜਿਹਦੇ ਵਿੱਚ ਕਾਫੀ ਹੋਰ ਗੁਲਾਬ ਵਿੱਚ ਵੀ ਕਈ ਕਲਰ ਹੈਗੇ ਹੈ ਅਲੱਗ ਅਲੱਗ ਰੰਗਾਂ ਦੇ ਗੁਲਾਬ ਹੈ ਹਾਂਜੀ ਹਾਂਜੀ ਮੈਮ ਇਹਨਾਂ ਦੇ ਰੇਟ ਵੀ ਅਲੱਗ ਅਲੱਗ ਹੈ

ਹਾਂਜੀ ਮੈਮ ਉਹਨਾਂ ਵਿੱਚ ਵੀ ਜਿੱਦਾਂ ਅੰਬ ਦਾ ਹੈਗਾ ਹੈ ਲੀਚੀ ਹੈ ਪਪੀਤਾ ਹੈ ਆੜੂ ਹੈ ਬਹੁਤ ਸਾਰੇ ਫਲ਼ ਹੈ ਇਸ ਮੌਸਮ 'ਚ ਤਾਂ ਮੈਮ ਤੁਸੀਂ ਅੰਬ ਲਗਾ ਸਕਦੇ ਹੋ ਮੈਮ ਨਹੀਂ ਇਸ ਮੌਸਮ ਵਿੱਚ ਲੀਚੀ ਲਗਾਉਗੇ ਨਾ ਤਾਂ ਉਹ ਹੋਣਾ ਨਹੀਂ ਹੈਗਾ ਲੀਚੀ ਦਾ ਕਿਉਂਕਿ ਉਸਦਾ ਮੌਸਮ ਨਹੀਂ ਹੈਗਾ ਹੁਣ ਹੁਣ ਅੰਬ ਦਾ ਮੌਸਮ ਚੱਲ ਰਿਹਾ ਤਾਂ ਉਹੀ ਹੀ ਪੌਦਾ ਹੋਏਗਾ ਹਾਂਜੀ ਤੁਸੀਂ ਜੇ ਲੀਚੀ ਦਾ ਲਗਾਉਣਾ ਹੋਇਆ ਤਾਂ ਤੁਸੀਂ ਨਵੰਬਰ ਦਸੰਬਰ ਵਿੱਚ ਲਗਾ ਸਕਦੇ ਹੋ ਅੱਗੇ ਚੱਲ ਕੇ ਹਾਂਜੀ ਹਾਂਜੀ ਮਿੱਟੀ ਵੀ ਇਨ੍ਹਾਂ ਦੀ ਅਲੱਗ ਅਲੱਗ ਹੈ ਜਿੱਦਾਂ ਤੁਸੀਂ ਇਸ ਦੇ ਲਈ ਅੰਬ ਵਾਲੀ ਮਿੱਟੀ ਲਉਗੇ ਨਾ ਤਾਂ ਉਹ ਰੇਤਲੀ ਮਿੱਟੀ ਵਿੱਚ ਜਲਦੀ ਹੋ ਜਾਏਗਾ ਹਾਂਜੀ ਮੈਡਮ ਖਾਦ ਵੀ ਪਾਉਣੀ ਪੈਂਦੀ ਹੈ ਉਹ ਤੁਹਾਨੂੰ ਸਾਡੇ ਪਾਸ ਹੀ ਮਿਲ ਜਾਊਗੀ ਹਾਂਜੀ ਹਾਂਜੀ ਮੈਡਮ ਠੀਕ ਹੈ ਜੀ ਤੁਸੀਂ ਸ਼ਾਮੀ ਆ ਜਾਉ ਫਿਰ ਆਪਾਂ ਗੱਲ ਕਰਦੇ ਹਾਂ ਬੈਠ ਕੇ ਅੋਰ ਫਿਰ ਇਨ੍ਹਾਂ ਦੇ ਰੇਟ ਵੀ ਤੁਹਾਨੂੰ ਅਲੱਗ ਅਲੱਗ ਦੱਸ ਦਿਆਂਗੇ ਹਾਂਜੀ ਮੈਂ ਸ਼ਾਮ ਨੂੰ ਤੁਹਾਨੂੰ ਨਰਸਰੀ 'ਚ ਮਿਲਾਂਗੀ ਠੀਕ ਹੈ ਆਉਣ ਤੋਂ ਪਹਿਲਾਂ ਇੱਕ ਵਾਰ ਕਾਲ ਕਰ ਲਿਉ ਜੀ ਓਕੇ ਜੀ ਓਕੇ ਹਾਂਜੀ ਠੀਕ ਹੈ ਮੈਡਮ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਤੁਹਾਡਾ ਤੁਹਾਡਾ ਸੁਆਗਤ ਹੈ ਤੁਸੀਂ ਆਉ ਠੀਕ ਹੈ ਜੀ ਓਕੇ